ਛੋਟਾ ਜਾਂ ਵੱਡਾ ਕੋਈ ਵੀ ਕਾਰੋਬਾਰ ਸਥਾਪਤ ਕਰਨ ਲਈ ਬਹੁਤ ਹੌਂਸਲੇ ਦੀ ਲੋੜ ਪੈਂਦੀ ਹੈ ਸਾਡੇ ਦੇਸ਼ ਦੀ ਆਰਥਿਕਤਾ ਦੀ ਮੌਜੂਦਾ ਸਥਿਤੀ ਅਤੇ ਬੇਰੁਜ਼ਗਾਰੀ ਦੀ ਦਰ ਨਾਲ ਆਪਣੀ ਮਰਜ਼ੀ ਨਾਲ ਸਾਨੂੰ ਇਸ ਬਹਾਦਰੀ ਨੂੰ ਦਰਸਾਉਣਾ ਅਤੇ ਕਾਰੋਬਾਰ ਦੇ ਉਦਯੋਗ ਅਤੇ ਵਿਸ਼ਾਲ ਸਮੁੰਦਰ ਵਿੱਚ ਆਪਣੇ ਪੈਰ ਫਸਾਉਣ ਦੀ ਜ਼ਰੂਰਤ ਹੈ ਸਾਡੇ ਲਈ ਇਹ ਚੁਣਨ ਲਈ ਇੱਕ ਵਿਕਲਪ ਉਪਲਬਧ ਹੈ ਕਿ ਸਾਨੂੰ ਕਿਸ ਕਾਰੋਬਾਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਭਾਵੇਂ ਇਹ ਨਿਵੇਸ਼ ਘੱਟ ਜਾਂ ਵੱਧ ਹੋਵੇ ਕੁਝ ਮੁਸ਼ਕਿਲਾਂ ਹਨ ਜੋ ਸਾਨੂੰ ਕਿਸੇ ਮੁਸੀਬਤ ਵਿੱਚ ਪੈਣ ਤੋਂ ਬਚਣ ਲਈ ਜਾਨਣੀਆਂ ਚਾਹੀਦੀਆਂ ਹਨ ਇੱਥੇ ਕੁਝ ਸੁਝਾਅ ਹਨ ਜੋ ਤੁਹਾਨੂੰ ਆਪਣੇ ਨਵੇਂ ਉੱਧਮ ਲਈ ਕਾਰੋਬਾਰ ਯੋਜਨਾ ਨੂੰ ਡਿਜ਼ਾਇਨ ਕਰਨ ਤੋਂ ਪਹਿਲਾਂ ਜਾਣਨਾ ਚਾਹੀਦਾ ਹੈ ਕਿ ਭਾਵੇਂ ਓਨਲਾਈਨ ਹੋਵੇ ਜਾਂ ਓਫਲਾਈਨ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਵੱਖੋ ਵੱਖਰੇ ਜੋਖ਼ਮਾਂ ਵਿੱਚ ਗੁਜ਼ਰ ਚੁੱਕੇ ਹੋ ਜੋ ਲਾਭ ਦੇ ਨਾਲ ਨਾਲ ਇੱਕ ਨਵਾਂ ਕਾਰੋਬਾਰ ਸ਼ੁਰੂ ਕਰਨ ਵਿੱਚ ਸ਼ਾਮਿਲ ਹਨ ਵੱਖ ਵੱਖ ਮਾਰਕੀਟ ਰੋਜ਼ਾਨਾ ਅਤੇ ਸਰਕਾਰੀ ਯੋਜਨਾਵਾਂ ਨੂੰ ਵੇਖਦੇ ਰਹੋ ਜਾਂ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਕੇਂਦਰਿਤ ਕਰਨ ਹਨ ਅਤੇ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਉਹਨਾਂ ਵਿੱਚੋਂ ਸਭ ਤੋਂ ਵਧੀਆ ਬਣਾਉਂਦੇ ਹਨ